ਰਾਜ ਸਰਕਾਰ ਅਤੇ ਕੇਂਦਰ ਸਰਕਾਰ ਲੋਕਾਂ ਦੀ ਜਨਤਾ ਦੀ ਸਿਹਤ ਦੀ ਸੰਭਾਲ ਲਈ ਬੜੇ ਏੜੀ ਚੋਟੀ ਦਾ ਜੋੜ ਲਗਾ ਰਹੀ ਹੈ ਅਤੇ ਉਸ ਵਿੱਚ ਉਹ ਕੋਸ਼ਿਸ਼ ਕਰ ਰਹੀ ਹੈ ਕਿ ਜਨ ਜਨ ਦੀ ਸਿਹਤ ਦੀ ਸੁਚਾਰੂ ਰੂਪ 'ਤੇ ਸੰਭਾਲ ਕੀਤੀ ਜਾਵੇ ਅਤੇ ਉਹ ਇਸ ਲਈ ਰੋ ਉਹ ਆਪ ਸਰਕਾਰ ਨੇ ਆਪ ਪੰਜਾਬ ਦੀ ਰਾਜ ਸਰਕਾਰ ਜਿਹੜੀ ਹੈ ਇਸ ਵੇਲੇ ਦੀ ਉਹ ਇਸ ਵ ਉਹਨਾਂ ਨੇ ਨਵੀਆਂ ਨਵੀਆਂ ਡਿਸਪੈਂਸਰੀਆਂ ਪੰਜਾਬ ਰਾਜ ਦੇ ਵਿੱਚ ਖੋਲ੍ਹੀਆਂ ਹੈ ਅਤੇ ਨਵੇਂ ਹੋਰ ਜ ਜ਼ਿਆਦਾ ਤੋਂ ਜ਼ਿਆਦਾ ਉਹ ਡਾਕਟਰਾਂ ਦੀ ਭਰਤੀ ਕਰ ਰਹੀ ਹੈ ਅਤੇ ਕਈ ਨਵੀਆਂ ਨਵੀਆਂ ਸਕੀਮਾਂ ਵੀ ਚਲਾ ਰਹੀ ਹੈ ਜਿਸ ਦੇ ਨਾਲ ਕਿ ਉਹ ਹਰ ਬੰਦੇ ਦੀ ਚੰ ਸੰਚਾਰੂ ਰੂਪ ਦੇ ਵਿੱਚ ਸੰਭਾਲ ਕਰ ਸਕੇ ਜਿਸ ਦੇ ਵਿੱਚੋਂ ਉਹ ਉਹ ਨਵੀਂ ਸਕੀਮ ਕਈ ਨਵੀਆਂ ਸਕੀਮਾਂ ਵੀ ਹੈ ਕਿ ਜਿਸ ਨਾਲ ਕਿ ਹਰ ਇੱਕ ਬੰਦਾ ਘੱਟ ਘੱਟ ਦੂਰੀ ਤੋਂ ਆਪਣੇ ਘਰ ਦੇ ਪਾਸ ਹੀ ਉਸ ਉਹਨਾਂ ਹਰ ਇੱਕ ਸਰਕਾਰ ਦੀ ਹਰ ਇੱਕ ਯੋਜਨਾ ਦਾ ਅਤੇ ਸਿਹਤ ਯੋਜਨਾ ਦਾ ਲਾਭ ਉਠਾ ਸਕੇ